ਹੈਲੋ ਸਰ ਤੁਸੀਂ ਜਲ ਅਥੋਰਟੀ ਤੋਂ ਬੋਲ ਰਹੇ ਹਾਗੇ ਸਾਡੇ ਇੱਥੇ ਮੁਕਤਸਰ ਏਰੀਏ ਦੇ ਨਾਲ ਸਾਡਾ ਇੱਕ ਪਿੰਡ ਲੱਗਦਾ ਗਿਆ ਜਿੱਥੇ ਕਿ ਪਾਣੀ ਦੀ ਬਹੁਤ ਹੀ ਜ਼ਿਆਦਾ ਪ੍ਰੋਬਲਮ ਹੈਗੀ ਹੈਗੀ ਅਸੀਂ ਇਹ ਪ੍ਰੋਬਲਮ ਅਸੀਂ ਦੂਰੋਂ ਕਾਫੀ ਦੂਰੋਂ ਸ਼ਿਫਟ ਹੋਏ ਹੈਗੇ ਇੱਥੇ ਇਸ ਪਿੰਡ ਦੇ ਵਿੱਚ ਸਾਨੂੰ ਹੁਣ ਪਾਣੀ ਦੀ ਕਾਫੀ ਜ਼ਿਆਦਾ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਗਿਆ ਪਲੀਜ਼ ਕਿਰਪਾ ਕਰਕੇ ਕਰਕੇ ਤੁਸੀਂ ਪਾਣੀ ਦਾ ਚੰਗਾ ਤੋਂ ਚੰਗਾ ਪ੍ਰਬੰਧ ਕਰੋ ਨੇੜੇ ਦੀਵਾਲੀ ਆ ਰਹੀ ਹੈ ਕਿਉਂਕਿ ਸਾਨੂੰ ਪਾਣੀ ਦੀ ਬਹੁਤ ਸਖ਼ਤ ਤੋਂ ਸਖ਼ਤ ਲੋੜ ਹੈ ਅਤੇ ਪਾਣੀ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਅਤੇ ਪੀਣ ਦੇ ਲਈ ਵੀ ਪਾਣੀ ਦੀ ਹਾਲਤ ਕਾਫੀ ਜ਼ਿਆਦਾ ਖ਼ਰਾਬ ਆਗੀ ਤੇ ਸਾਫ਼ ਪਾਣੀ ਦਾ ਪਲੀਜ਼ ਪ੍ਰਬੰਧ ਕੀਤਾ ਜਾਵੇ ਪਾਣੀ ਸਾਡੇ ਕਾਫੀ ਕੰਮ ਪਾਣੀ ਦੇ ਕਰਕੇ ਇਹ ਰੁਕੇ ਹੋਏ ਹਨ ਪਲੀਜ਼ ਸਰ ਸਾਨੂੰ ਜਲਦੀ ਤੋਂ ਜਲਦੀ ਪਾਣੀ ਪਾਣੀ ਦੀ ਸਮੱਸਿਆ ਸਾਡੀ ਦੂਰ ਕੀਤੀ ਜਾਵੇ